ਮੈਂ ਸਭ ਤੋਂ ਪਹਿਲਾਂ ਸਫਰ ਸ਼੍ਰੀ ਹੇਮਕੁੰਡ ਸਾਹਿਬ ਦਾ ਕੀਤਾ ਸੀ ਉਸ ਸਮੇਂ ਮੈਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਪਹਾੜੀ ਖੇਤਰ ਹੋਣ ਕਰਕੇ ਅਤੇ ਮੋਟਰਸਾਈਕਲ ਚਲਾਉਣਾ ਮੁਸ਼ਕਿਲ ਸੀ ਜਿਸ ਦੌਰਾਨ ਉੱਥੇ ਸਾਵਧਾਨੀ ਵਰਤਣੀ ਪੈਂਦੀ ਸੀ ਉੱਥੇ ਇੱਕ ਪਾਸੇ ਪਹਾੜ ਅਤੇ ਦੂਜੇ ਪਾਸੇ ਖਾਈ ਸੀ ਜਿਸ ਕਰਕੇ ਉੱਥੇ ਬਹੁਤ ਹੀ ਸਾਵਧਾਨੀ ਨਾਲ ਮੋਟਰਸਾਈਕਲ ਚਲਾਉਣਾ ਪੈਂਦਾ ਸੀ ਅਤੇ ਮੋਟਰਸਾਈਕਲ 'ਤੇ ਸਵਾਰ ਹੋਣ ਦੌਰਾਨ ਮੈਨੂੰ ਬੜੀ ਹੀ ਵੱਡੀ ਚਿੰਤਾ ਸਤਾਉਂਦੀ ਸੀ ਹੈਲਮਟ ਪਹਿਨਣ ਦੇ ਬਾਵਜੂਦ ਵੀ ਉੱਥੇ ਕਈ ਸਾਰੇ ਹਾਦਸੇ ਵਾਪਰਦੇ ਸੀ ਉੱਥੇ ਯਾਤਰੀਆਂ ਦੀ ਬੜੀ ਭੀੜ ਸ਼ਹਿਰੀ ਖੇਤਰ ਹੋਣ ਕਰਕੇ ਭੀੜ ਕਰਕੇ ਮੋਟਰਸਾਈਕਲ ਚਲਾਉਣਾ ਬੜਾ ਮੁਸ਼ਕਿਲ ਸੀ ਅਤੇ ਕਈ ਲੋਕ ਉੱਥੇ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਸੀ ਜਿਸ ਕਰਕੇ ਟਰੈਫਿਕ ਜ਼ਿਆਦਾ ਹੋਣ ਕਰਕੇ ਉੱਥੇ ਬੜਾ ਮੁਸ਼ਕਿਲ ਹੋ ਜਾਂਦਾ ਸੀ ਮੈਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਕਈ ਵਾਰ ਮੌਸਮ ਖਰਾਬ ਹੋਣ ਦੇ ਦੌਰਾਨ ਮੈਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਈ ਵਾਰ ਮੀਂਹ ਪੈਣ ਲੱਗ ਪੈਂਦਾ ਸੀ ਉਦੋਂ ਮੋਟਰਸਾਈਕਲ ਚਲਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਸੀ ਕਈ ਵਾਰ ਧੁੱਪ ਜ਼ਿਆਦਾ ਹੋਣ ਕਰਕੇ ਜਾਂ ਕਈ ਵਾਰ ਹਨੇਰੀ ਆਉਣ ਕਰਕੇ ਮੋਟਰਸਾਈਕਲ ਡੋਲਦਾ ਸੀ ਅਤੇ ਉਸ ਦੌਰਾਨ ਮੋਟਰਸਾਈਕਲ ਚਲਾਉਣਾ ਬੜਾ ਮੁਸ਼ਕਿਲ ਸੀ ਅਤੇ ਪਾਰਕਿੰਗ ਦੇ ਪਾਰਕਿੰਗ ਦੀ ਬੜੀ ਸਮੱਸਿਆ ਆਉਂਦੀ ਸੀ ਉੱਥੇ ਪਾਰਕ ਮੋਟਰਸਾਈਕਲ ਪਾਰਕ ਕਰਨਾ ਬੜਾ ਔਖਾ ਸੀ ਇੱਕ ਇੱਕ ਚੁਣੌਤੀ ਭਰਿਆ ਸੀ ਕਈ ਵਾਰ ਚੋਰੀ ਨਾ ਹੋ ਜਾਏ ਮੋਟਰਸਾਈਕਲ ਜਾਂ ਭੀੜ ਵਾਲੇ ਖੇਤਰਾਂ ਵਿੱਚ ਪਾਰਕਿੰਗ ਬੜੀ ਘੱਟ ਮਿਲਦੀ ਸੀ ਮੈਨੂੰ ਰਸਤੇ ਦੀਆਂ ਮੁਸ਼ਕਿਲਾਂ ਦਾ ਬੜਾ ਸਾਹਮਣਾ ਕਰਨਾ ਪਿਆ ਉੱਥੇ ਖਰਾਬ ਸੜਕਾਂ ਸੀ ਕਈ ਵਾਰ ਗੜ੍ਹੇ ਆ ਜਾਂਦੇ ਸੀ ਕਈ ਵਾਰ ਰਸਤਾ ਹੋਰ ਮੁਸ਼ਕਿਲ ਹੋ ਜਾਂਦਾ ਜਿਸ ਕਰਕੇ ਮੋਟਰਸਾਈਕਲ ਚਲਾਉਣਾ ਮੁਸ਼ਕਿਲ ਸੀ ਕਈ ਵਾਰ ਭੀੜ ਦੇ ਇਲਾਕੇ ਵਿੱਚ ਟਰੈਫਿਕ ਜਾਮ ਹੋ ਜਾਂਦਾ ਸੀ ਸ਼ਹਿਰੀ ਖੇਤਰਾਂ ਵਿੱਚ ਟਰੈਫਿਕ ਜਾਮ ਹੋਣ ਕਰਕੇ ਉੱਥੋਂ ਲੰਘਣਾ ਬੜਾ ਮੁਸ਼ਕਿਲ ਹੋ ਜਾਂਦਾ ਸੀ ਅਤੇ ਗੱਡੀਆਂ ਜੇ ਗੱਡੀ ਵਾਲੇ ਵੀ ਉਹਨਾਂ ਗੱਡੀਆਂ ਚਲਾਉਣਾ ਔਖੀਆਂ ਸੀ ਮੋਟਰਸਾਈਕਲ ਵੀ ਬੜਾ ਚਲਾਉਣਾ ਕਾਫੀ ਰਸਤੇ ਬੜੇ ਖਰਾਬ ਸੀ ਗੱਡੀਆਂ ਦੀਆਂ ਸਮੱਸਿਆਵਾਂ ਜਿਵੇਂ ਇੰਜਣ ਬੜੇ ਇੰਜਣ ਦੀ ਗਰਮੈਸ਼ ਪੈਂਦੀ ਸੀ ਅਤੇ ਗੱਡੀਆਂ ਲੰਘਣ ਸਮੇਂ ਉਦੋਂ ਮੋਟਰਸਾਈਕਲ ਲੰਘਾਉਣਾ ਬੜਾ ਔਖਾ ਹੋ ਜਾਂਦਾ ਸੀ ਥਕਾਵਟ ਬੜੀ ਹੋ ਗਈ ਸੀ ਲੰਮੇ ਸਮੇਂ ਮੋਟਰਸਾਈਕਲ ਚਲਾਉਣ ਕਰਕੇ ਥਕਾਵਟ ਦਾ ਬੜਾ ਸਾਹਮਣਾ ਕਰਨਾ ਪਿਆ ਉਦੋਂ ਲੱਕ 'ਚ ਦਰਦ ਹੋਣ ਲੱਗ ਪਈ ਅਤੇ ਜੇ ਕਈ ਵਾਰ ਟਰੈਫਿਕ ਨਿਯਮਾਂ 'ਤੇ ਕੋਈ ਅਣਦੇਖੀ ਕਰਦਾ ਸੀ ਤਾਂ ਉਹਦੇ ਨਾਲ ਕਈ ਵਾਰ ਹਾਦਸਾ ਵਾਪਰ ਜਾਂਦਾ ਸੀ ਅਤੇ ਹਾਦਸੇ ਵਾਪਰਨ ਕਰਕੇ ਉਦੋਂ ਫਿਰ ਮੁਸ਼ਕਿਲ ਹੋ ਜਾਂਦੀ ਸੀ ਹਸਪਤਾਲ ਵਿੱਚ ਦਾਖਲ ਕਰਾਉਣਾ ਜਾਂ ਉੱਥੇ